ਮੀਡੀਆ ਜਿਵੇਂ ਰੇਡੀਓ ਟੈਲੀਵਿਜ਼ਨ ਅਤੇ ਪ੍ਰਿੰਟ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਵੀ ਹੋਣ ਲੱਗ ਪਈ ਹੈ ਪੰਜਾਬੀ ਦੀ ਭਾਸ਼ਾ ਦੀ ਵਰਤੋਂ ਕਾਫ਼ੀ ਵਿਆਪਕ ਪੱਧਰ 'ਤੇ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਮੀਡੀਆ ਵਿੱਚ ਜਿਵੇਂ ਕਿ ਰੇਡੀਓ ਵਗੈਰਾ ਵਿੱਚ ਕਾਫ਼ੀ ਜ਼ਿਆਦਾ ਹੋਣ ਲੱਗ ਪਈ ਹੈ ਕਿਉਂਕਿ ਪੰਜਾਬੀ ਬੋਲਣ ਨਾਲ ਅਤੇ ਪੰਜਾਬੀ ਸਮਝਣ ਵਾਲਾ ਖਿੱਤਾ ਹੈ ਜਾਂ ਉਹਦੇ ਸਰੋਤੇ ਨੇ ਉਹ ਬਹੁਤ ਵੱਧ ਗਏ ਹਨ ਦੇਸ਼ ਵਿਦੇਸ਼ਾਂ ਵਿੱਚ ਵੀ ਪੰਜਾਬੀ ਨੂੰ ਸਮਝਣ ਵਾਲੇ ਲੋਕ ਬੈਠੇ ਹਨ ਅਤੇ ਰੇਡੀਓ ਉੱਤੇ ਵੀ ਜਿਵੇਂ ਬਠਿੰਡਾ ਅਕਾਸ਼ਬਾਣੀ ਅਕਾਸ਼ਬਾਣੀ ਜਲੰਧਰ ਵਰਗੇ ਸਟੇਸ਼ਨ ਜੋ ਚੱਲ ਰਹੇ ਹਨ ਲੋਕਾਂ ਨੂੰ ਉਹਨਾਂ ਦੀ ਆਪਣੀ ਮਾਤ ਭਾਸ਼ਾ ਵਿੱਚ ਗੱਲ ਨੂੰ ਸਮਝਾ ਰਹੇ ਹਨ ਕਿਉਂਕਿ ਮਾਤ ਭਾਸ਼ਾ ਵਿੱਚ ਗੱਲ ਸਮਝਣੀ ਬਹੁਤ ਹੀ ਔ ਸੌਖੀ ਰਹਿੰਦੀ ਹੈ ਇਸ ਕਰਕੇ ਮੀਡੀਆ ਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ ਟੈਲੀਵਿਜ਼ਨ ਉੱਤੇ ਵੀ ਕਈ ਜਲੰਧਰ ਦੂਰਦਰਸ਼ਨ ਵਰਗੇ ਪ੍ਰੋਗਰਾਮ ਆਉਂਦੇ ਹਨ ਜਿਸ ਵਿੱਚ ਖ਼ਬਰਾਂ ਵਗੈਰਾ ਸੁਣਾਈਆਂ ਜਾਂਦੀਆਂ ਹਨ ਅਤੇ ਹੋਰ ਵੀ ਡੀ ਡੀ ਪੰਜਾਬੀ ਪ੍ਰੋਗਰਾਮ ਚੱਲਦੇ ਹਨ ਪੀ ਟੀ ਸੀ ਵਗੈਰਾ ਚੈਨਲ ਚੱਲਦੇ ਹਨ ਜੋ ਜੋ ਕਿ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਦੇ ਵੀ ਹਨ ਅਤੇ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਵੀ ਕਰਦੇ ਹਨ ਅਤੇ ਲੋਕਾਂ ਨੂੰ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਉਹਨਾਂ ਦਾ ਮਨੋਰੰਜਨ ਵੀ ਕਰਦੇ ਹਨ ਜੇ ਪ੍ਰਿੰਟ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਪ੍ਰਿੰਟ ਮੀਡੀਆ ਵਿੱਚ ਵੀ ਪੰਜਾਬੀ ਦੀ ਵਰਤੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਟਕਸਾਲੀ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਪੰਜਾਬੀ ਭਾਸ਼ਾ ਜੋ ਕਿ ਲਿਖਣ ਪੜ੍ਹਨ ਲਈ ਵਰਤੀ ਜਾਂਦੀ ਹੈ ਉਸ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਲੋਕਲ ਬੋਲੀਆਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ ਕਿਉਂਕਿ ਅਖ਼ਬਾਰ ਨੂੰ ਜਰਨਾਲਾਇਜ ਕੀਤਾ ਜਾਂਦਾ ਹੈ ਸਾਰੇ ਪੰਜਾਬੀ ਬੋਲਣ ਵਾਲੇ ਖਿੱਤੇ ਹੀ ਅਖ਼ਬਾਰ ਨੂੰ ਪੜ੍ਹਦੇ ਨੇ ਤਾਂ ਉਹ ਭਾਸ਼ਾ ਵਰਤੀ ਜਾਂਦੀ ਹੈ ਜੋ ਕਿ ਸਾਰੇ ਲੋਕਾਂ ਦੇ ਸਮਝ ਵਿੱਚ ਆ ਜਾਵੇ ਤਾਂ ਪੰਜਾਬੀ ਨੂੰ ਪ੍ਰਿੰਟ ਮੀਡੀਆ ਜਾਂ ਇਸ ਵਿੱਚ ਵਰਤਣ ਲਈ ਬਹੁਤ ਜ਼ਿਆਦਾ ਹੁਣ ਬ ਹੁਲਾਰਾ ਮਿਲ ਰਿਹਾ ਹੈ ਪੰਜਾਬੀ ਭਾਸ਼ਾ ਕਾਫ਼ੀ ਵਿਆਪਕ ਹੋ ਚੁੱਕੀ ਹੈ ਅਖ਼ਬਾਰ ਵਗੈਰਾ ਵੀ ਜਿਵੇਂ ਜਗਬਾਣੀ ਅਖ਼ਬਾਰ ਅਜੀਤ ਅਖ਼ਬਾਰ ਪੰਜਾਬੀ ਟ੍ਰਿਬਿਊਨ ਅਖ਼ਬਾਰ ਪ੍ਰਿੰਟ ਮੀਡੀਆ ਵਿੱਚ ਕਾਫ਼ੀ ਵੱਡਾ ਯੋਗਦਾਨ ਪਾ ਰਹੇ ਹਨ ਲੋਕ ਇਹਨਾਂ ਅਖ਼ਬਾਰਾਂ ਨੂੰ ਸ਼ੌਂਕ ਨਾਲ ਪੜ੍ਹਦੇ ਹਨ ਪੰਜਾਬੀ ਨਾਲ ਜੋ ਜੁੜੇ ਹੋਏ ਲੋਕ ਹਨ ਜੋ ਪੰਜਾਬੀ ਪੜ੍ਹਨਾ ਪਸੰਦ ਕਰਦੇ ਹਨ ਪੰਜਾਬੀ ਬੋਲਣਾ ਪਸੰਦ ਕਰਦੇ ਹਨ ਉਹਨਾਂ ਲਈ ਇੱਕ ਚਾਅ ਚੜ੍ਹ ਜਾਂਦਾ ਹੈ ਉਹਨਾਂ ਨੂੰ ਜਦੋਂ ਉਹਨਾਂ ਦੀ ਭਾਸ਼ਾ ਵਿੱਚ ਕੋਈ ਵੀ ਚੀਜ਼ ਮੀਡੀਆ ਵਿੱਚ ਆਉਂਦੀ ਹੈ ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਚਾਹੇ ਉਹ ਟੈਲੀਵਿਜ਼ਨ ਹੋਵੇ ਚਾਹੇ ਉਹ ਰੇਡੀਓ ਹੋਵੇ ਉਹ ਉਸ ਨਾਲ ਜੁੜ ਜਾਂਦੇ ਹਨ ਤਾਂ ਪੰਜਾਬੀ ਦਾ ਮੀਡੀਆ ਵਿੱਚ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਖਿੱਤੇ ਲਈ ਪੰਜਾਬੀ ਬੋਲਣ ਵਾਲੇ ਲੋਕਾਂ ਲਈ ਜਦੋਂ ਪੰਜਾਬੀ ਦੀ ਵਰਤੋਂ ਕਿਸੇ ਮੀਡੀਆ 'ਚ ਚੀਜ਼ ਵਿੱਚ ਕੀਤੀ ਜਾਂਦੀ ਹੈ ਚਾਹੇ ਰੇਡੀਓ ਹੋਵੇ ਟੈਲੀਵਿਜ਼ਨ ਹੋਵੇ ਜਾਂ ਕਿਸੇ ਅਖ਼ਬਾਰ ਰਸਾਲਾ ਮੈਗਜ਼ੀਨ ਹੋਵੇ ਤਾਂ ਲੋਕ ਬਹੁਤ ਹੀ ਆਨੰਦ ਨਾਲ ਉਸਨੂੰ ਪੜ੍ਹਦੇ ਹਨ ਉਸ ਨੂੰ ਸੁਣਦੇ ਹਨ ਅਤੇ ਬਹੁਤ ਆਨੰਦ ਮਹਿਸੂਸ ਕਰਦੇ ਹਨ